ਹੈਲੋ ਹੈਲੋ ਹਾਂਜੀ ਕੌਣ ਜੀ ਸਰਬ ਜੀ ਜੀ ਸਰਬਜੀਤ ਦੀਦੀ ਬੋਲਦੇ ਹੋ ਜੀ ਅਸੀਂ ਜੀ ਜਗ ਬਾਣੀ ਅਖ਼ਬਾਰ ਪੱਤਰ ਤੋਂ ਬੋਲ ਰਹੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜੀ ਮੁਕਤਸਰ ਦਾ ਇਤਿਹਾਸ ਕੀ ਹੋਇਆ ਸੀ ਹਾਂਜੀ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਜੀ ਠੀਕ ਹੈ ਜੀ ਜੀ ਹਾਂ ਅਤੇ ਉਹ ਛਿੱਤਰ ਕਿਵੇਂ ਮਾਰਦੇ ਆ ਜੀ ਮੁਸਲਮਾਨ ਦੀ ਉਹ ਮਕਾਨ ਬਣੀ ਹੋਈ ਹੈ ਮੁਕਤਸਰ 'ਚ ਉਹ ਕਿਵੇਂ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਠੀਕ ਹੈ ਜੀ ਜੀ ਨਹੀਂ ਜੀ ਸਾਨੂੰ ਨਹੀਂ ਪਤਾ ਜੀ ਤਾਹੀਓਂ ਅਸੀਂ ਤੁਹਾਨੂੰ ਫੋਨ ਲਾਇਆ ਜੀ ਪੁੱਛ ਲਈਏ ਹਾਂਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਦੱਸਣ ਲਈ ਹਾਂਜੀ